ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸਾਨੂੰ ਹਰ ਇੱਕ ਤਰ੍ਹਾਂ ਦਾ ਬੰਦਾ ਮਿਲਦਾ ਹੈ ਜੋ ਕਿ ਆਪਣੇ ਕਲਾਕਾਰੀ ਕਰਕੇ ਆਪਣੇ ਚਿੱਤਰਕਾਰੀ ਕਰਕੇ ਮਸ਼ਹੂਰ ਹੁੰਦਾ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਕੱਲ੍ਹ ਇੱਕ ਇੰਸਟਾਗਰਾਮ ਐਪ ਹੈ ਜੋ ਕਿ ਜਿਸ ਨੇ ਬੰਦੇ ਨੂੰ ਬਹੁਤ ਹੀ ਫੇਮਸ ਕਰ ਦਿੱਤਾ ਇਸ 'ਤੇ ਅਸੀਂ ਰੀਲਾਂ ਦੇਖ ਸਕਦੇ ਹਾਂ ਫੋਟੋਆਂ ਪਾ ਸਕਦੇ ਹਾਂ ਜਾਂ ਕੋਈ ਹੋਰ ਵੀ ਚੀਜ਼ਾਂ ਜਿਵੇਂ ਅਡੀਟਿੰਗ ਕਰਨੀ ਹੋਵੇ ਕਰ ਸਕਦੇ ਹਾਂ ਇਹ ਦੋ ਹਜ਼ਾਰ ਦਸ ਵਿੱਚ ਦੋ ਦੋਸਤਾਂ ਦੁਆਰਾ ਬਣਾਇਆ ਗਿਆ ਸੀ ਜਿਹਨਾਂ ਦਾ ਨਾਮ ਸੀ ਕੈਵਿਨ ਸਿਸਟ੍ਰੋਮ ਐਂਡ ਮਾਈਕ ਕ੍ਰੀਗਰ ਇਹਨਾਂ ਨੇ ਇਹਨਾਂ ਨੇ ਲੋਕਾਂ ਦੀ ਸੋਚ ਅਤੇ ਵੱਧਦੇ ਟੈਲੈਂਟ ਨੂੰ ਦੇਖ ਕੇ ਇੰਸਟਾਗਰਾਮ ਨੂੰ ਉਪਲਬਧ ਕੀਤਾ ਇਹਨਾਂ ਨੇ ਦੇਖਿਆ ਕਿ ਪੰਜਾਬ ਵਿੱਚ ਕਈ ਲੋਕ ਨੇ ਭਾਰਤ ਵਿੱਚ ਕਈ ਲੋਕ ਨੇ ਜੋ ਕਿ ਆਪਣੇ ਆਪ ਨੂੰ ਅੱਗੇ ਲਿਆਉਣਾ ਚਾਹੁੰਦੇ ਹੈ ਪਰ ਉਹਨਾਂ ਨੂੰ ਕੋਈ ਮਾਧਿਅਮ ਨਹੀਂ ਮਿਲ ਰਿਹਾ ਉਹਨਾਂ ਨੇ ਇਸ ਮਾਧਿਅਮ ਨੂੰ ਦੇਖਦੇ ਹੋਏ ਉਹਨਾਂ ਨੇ ਇੰਸਟਾਗਰਾਮ ਲੋਕਾਂ ਵਿੱਚ ਇੰਟਰਡਿਊਸ ਕੀਤਾ ਜਿਹਦੇ ਵਿੱਚ ਲੋਕ ਉਸ ਟਾਇਮ ਪਹਿਲਾਂ ਤਾਂ ਇਕੱਲੀਆਂ ਫੋਟੋਆਂ ਜਾਂ ਵੀਡੀਓ ਹੀ ਪਾ ਸਕਦੇ ਸਨ ਬਟ ਇੰਸਟਾਗਰਾਮ ਨੇ ਅੱਜ ਦੇ ਟਾਇਮ ਵਿੱਚ ਇੰਸਟਾਗਰਾਮ 'ਤੇ ਅਸੀਂ ਰੀਲਾਂ ਵੀ ਕਰ ਸਕਦੇ ਹਾਂ ਰੀਲਾਂ ਅਪਡੇਟ ਵੀ ਕਰ ਸਕਦੇ ਹਾਂ ਕਈ ਰੀਲ ਸਟਾਰ ਤਾਂ ਇਸੇ ਉਤੋਂ ਹੀ ਬਣੇ ਹਨ ਅੱਜ ਕੱਲ੍ਹ ਮੇਰਾ ਇੱਕ ਕਈ ਫੇਮਸ ਡਾਂਸਰ ਵੀ ਇਸੇ ਉੱਤੋਂ ਬਣੇ ਹਨ ਜਿਵੇਂ ਕਿ ਲੈ ਲਓ ਆਕਾਸ਼ ਥਾਪਾ ਆਕਾਸ਼ ਥਾਪਾ ਇੱਕ ਬਹੁਤ ਹੀ ਫੇਮਸ ਡਾਂਸਰ ਹੈ ਜੋ ਕਿ ਪਹਿਲਾਂ ਤਾਂ ਉਸ ਨੇ ਸੋਸ਼ਲ ਮੀਡੀਆ ਦਾ ਇੱਕ ਐਪ ਸੀਗਾ ਫੇਸਬੁੱਕ ਉਹ ਤੋਂ ਹੀ ਉਹਨੇ ਸਟਾਟਿੰਗ ਕੀਤੀ ਸੀ ਬਟ ਹੌਲੀ ਹੌਲੀ ਉਹ ਇੰਸਟਾਗਰਾਮ 'ਤੇ ਆਇਆ ਇੰਸਟਾਗਰਾਮ 'ਤੇ ਆਉਣ ਦੇ ਨਾਲ ਨਾਲ ਉਹਦੇ ਬਹੁਤ ਹੀ ਫੋਲੋਅਰ ਵੱਧੇ ਅੱਜ ਦੇ ਟ੍ਰੈ ਸਮੇਂ ਵਿੱਚ ਉਸ ਨੂੰ ਤੀਹ ਤੋਂ ਚਾਲੀ ਲੱਖ ਫੋਲੋਅਰ ਮਿਲੇ ਹੋਏ ਨੇ ਇੰਸਟਾਗਰਾਮ 'ਤੇ ਜੋ ਕਿ ਬਹੁਤ ਹੀ ਉਸ ਨੂੰ ਮੋਟੀਵੇਟ ਕਰਦੇ ਹਨ ਕਿ ਤੂੰ ਹੋਰ ਵਧੀਆ ਕਰ ਸਕਦਾ ਹੈ ਆਕਾਸ਼ ਥਾਪਾ ਇੱਕ ਅਜਿਹਾ ਬੰਦਾ ਹੈ ਜਿਸ ਦੇ ਮੂਵਸ ਬਹੁਤ ਵਧੀਆ ਨੇ ਉਹ ਹਰ ਇੱਕ ਚੀਜ਼ ਬੜੇ ਆਰਾਮ ਨਾਲ ਕਰਦਾ ਹੈ ਅਤੇ ਨਾਲੇ ਲੋਕਾਂ ਨੂੰ ਇੱਦਾਂ ਉਹ ਦਿਖਾਉਂਦਾ ਹੈ ਕਿ ਬਹੁਤ ਇਜ਼ੀਲੀ ਕੰਮ ਹੋ ਰਿਹਾ ਹੈ ਆਕਾਸ਼ ਥਾਪਾ ਨੇ ਆਪਣੀ ਡਾਂਸਿੰਗ ਦੇ ਨਾਲ ਨਾਲ ਹੀ ਆਪਣੇ ਕਰੀਅਰ ਨੂੰ ਬਹੁਤ ਅੱਗੇ ਲੈ ਗਿਆ ਉਸ ਨੇ ਡੀ ਆਈ ਡੀ ਵਿੱਚ ਆਪਣਾ ਇੱਕ ਨਾਮ ਹਾਸਿਲ ਕੀਤਾ ਹੈ ਜੋ ਕਿ ਉਸ ਨੂੰ ਬਹੁਤ ਅੱਗੇ ਲੈ ਗਿਆ ਅੱਜ ਦੇ ਸਮੇਂ ਵਿੱਚ ਉਹ ਇੱਕ ਕੋਰੀਓਗ੍ਰਾਫਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਉਸ ਨੇ ਉਸ ਉਪਲਬਧੀ ਨੂੰ ਪਾਉਂਦੇ ਪਾਉਂਦਿਆਂ ਕਈ ਸਾਲ ਲਾ ਦਿੱਤੇ ਬਸ ਇੰਸਟਾਗਰਾਮ ਨੇ ਉਹਨੂੰ ਥੋੜ੍ਹੀ ਦੇਰ ਦੇ ਵਿੱਚ ਵਿੱਚ ਹੀ ਉਸ ਨੂੰ ਇੰਨਾ ਫੇਮਸ ਕਰ ਦਿੱਤਾ ਜੋ ਕਿ ਅੱਜ ਉਹ ਇੱਕ ਉੱਚੇ ਮੁਕਾਮ 'ਤੇ ਬੈਠਾ ਹੈ